ਧਰਮ ਦੇ ਖੇਤਰ ਵਿੱਚ ਸੈਰ ਸਪਾਟੇ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ ਇੱਥੇ ਕੁਝ ਧਾਰਮਿਕ ਸਥਾਨ ਅਤੇ ਗੁਰਦੁਆਰੇ ਹਨ ਜਿੱਥੇ ਲੋਕ ਧਾਰਮਿਕ ਅਨੁਭਵ ਅਤੇ ਸ਼ਾਂਤੀ ਦੇ ਲਈ ਆਉਂਦੇ ਹਨ ਜੀ ਹਾਂ ਇਹਨਾਂ ਧਾਰਮਿਕ ਥਾਵਾਂ ਵਿੱਚ ਵਿਸੇਸ਼ਤਾਵਾਂ ਹਨ ਜਿਵੇਂ ਕਿ ਗੁਰਦੁਆਰੇ ਜਿੱਥੇ ਲੋਕ ਆਉਂਦੇ ਹਨ ਅਤੇ ਧਾਰਮਿਕ ਪ੍ਰਭਾਵਸ਼ਾਲੀ ਮਾਹੌਲ ਹੁੰਦਾ ਹੈ ਇਹਨਾਂ ਥਾਵਾਂ 'ਤੇ ਲੋਕ ਆਉਂਦੇ ਹਨ ਅਤੇ ਆਪਣੇ ਧਾਰਮਿਕ ਅਨੁਭਵ ਦਾ ਆਨੰਦ ਲੈਂਦੇ ਹਨ ਅਤੇ ਪੰਜਾਬ ਵਿੱਚ ਕਈ ਸੁੰਦਰ ਜਗ੍ਹਾ ਹਨ ਜਿੱਥੇ ਲੋਕ ਆਉਂਦੇ ਹਨ ਕੁਝ ਪ੍ਰਸਿੱਧ ਥਾਂ ਵਿੱਚ ਸ਼ਾਮਿਲ ਹਨ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਜਲੰਧਰ ਦੇ ਮੇਲੇ ਚੰਡੀਗੜ੍ਹ ਦੀ ਰੋਜ਼ ਦੌੜ ਅਤੇ ਪਟਿਆਲਾ ਦੇ ਕਿਲ੍ਹੇ ਵੀ ਬਹੁਤ ਪ੍ਰਸਿੱਧ ਹਨ ਇਹ ਲੋਕ ਸੈਰ ਕਰਨ ਅਤੇ ਮਨੋਰੰਜਨ ਲਈ ਆਉਂਦੇ ਹਨ